ਹਾਂਜੀ ਹਾਂਜੀ ਵਧੀਆ ਚੱਲ ਰਿਹਾ ਜੀ ਵਧੀਆ ਮੈਡਮ ਬਸ ਇੱਕ ਗੱਲ ਤੋਂ ਐਵੇਂ ਪਰੇਸ਼ਾਨ ਹੋਈ ਜਾਂਦੀ ਹਾਂ ਉਹ ਰਮਨ ਨਹੀਂ ਹੈਗਾ ਆਪਣਾ ਸਟੂਡੈਂਟ ਉਸਦੇ ਅੱਜ ਪੇਰੈਂਟਸ ਆਏ ਸੀਗੇ ਉਹਨੂੰ ਮੈਂ ਕਿਸੇ ਇੱਕ ਗਲਤੀ ਤੋਂ ਝਿੜਕਿਆ ਸੀ ਅਤੇ ਬਸ ਐਵੇਂ ਕਹਿ ਰਹੇ ਸੀਗੇ ਕਿ ਸਾਡੇ ਬੱਚੇ ਨੂੰ ਨਾ ਝਿੜਕਿਆ ਕਰੋ ਇੱਦਾਂ

ਹਾਂਜੀ ਹਾਂਜੀ ਨਹੀਂ ਨਹੀਂ ਨਹੀਂ ਨਹੀਂ ਬਸ ਇਹ ਹੀ ਟੈਂਸ਼ਨ ਆ ਵੀ ਆਪਾਂ ਕੁਛ ਕਹਿ ਵੀ ਨਹੀਂ ਸਕਦੇ ਪੜ੍ਹਾਉਣਾ ਵੀ ਹੈ ਅਤੇ ਆਪਾਂ ਡਾਂਟਣਾ ਵੀ ਨਹੀਂ ਵੈਸੇ ਇਹ ਕੋਈ ਰੂਲ ਨਹੀਂ ਨਾ ਹੈਗਾ ਨਾ ਜੀ ਰੂਲ ਤਾਂ ਕੋਈ ਨਹੀਂ ਬੱਚਾ ਗਲਤੀ ਕਰ ਰਿਹਾ ਬਸ ਟੀਚਰ ਹੀ ਭੁਗਤੇ ਜੋ ਕਰੇ ਟੀਚਰ ਹੀ ਕਰੇ ਹਾਂ ਪੇਰੈਂਟਸ ਇਹ ਨਹੀਂ ਨਾ ਸੋਚਦੇ ਵੀ ਸਾਡੇ ਬੱਚੇ ਦਾ ਹੀ ਭਵਿੱਖ ਖ਼ਰਾਬ ਹੋ ਰਿਹਾ ਨਹੀਂ ਪਰ ਉਹਨਾਂ ਨੂੰ ਗਲਤ ਇੱਕ ਹਾਂਜੀ ਹਾਂ ਇੱਕ ਫੇਲ ਵੀ ਨਾ ਕਰੋ ਇੱਕ ਫੇਲ ਵੀ ਨਾ ਕਰੋ ਮੈਡਮ ਪਾਸ ਵੀ ਹੋਣਾ ਚਾਹੀਦਾ ਹਾਂ ਹਾਂ ਉਹ ਹੀ ਤਾਂ ਬਸ ਬਸ ਮੇਰਾ ਤਾਂ ਅੱਜ ਸੁਬਹਾ ਦਾ ਐਂ ਦਿਮਾਗ ਖ਼ਰਾਬ ਹੋਈ ਜਾਂਦਾ ਆ ਹੁਣ ਕੀ ਕਰੀਏ ਮੈਡਮ ਨਹੀਂ ਮੈਮ ਹਾਂਜੀ ਹਾਂਜੀ ਅਤੇ ਕਦੋਂ ਮੈ ਮੈਡਮ ਫਰੀ ਹੋਊਗੇ ਤਾਂ ਮੈਨੂੰ ਮਿਲਿਓ ਜ਼ਰੂਰ ਹਾਂ ਹਾਂਜੀ ਨਹੀਂ ਨਹੀਂ ਬਿਲਕੁਲ ਨਹੀਂ ਹਾਂਜੀ ਠੀਕ ਹੈ ਮੈਡਮ ਜਦੋਂ ਫਰੀ ਹੋਏ ਮੈਨੂੰ ਜ਼ਰੂਰ ਮਿਲਿਓ ਠੀਕ ਹੈ ਠੀਕ ਹੈ ਜੀ ਓਕੇ